ਪੌਦੇ ਆਮ ਤੌਰ 'ਤੇ ਬਹੁਤ ਹੀ ਕੋਮਲ ਹੁੰਦੇ ਹਨ ਜਿਹਨਾਂ ਦਾ ਧਿਆਨ ਬੱਚਿਆ ਵਾਂਗੂ ਰੱਖਣਾ ਪੈਂਦਾ ਹੈ ਕੁਝ ਅਜਿਹੇ ਪੌਦੇ ਹਨ ਜੋ ਕਿ ਗਰਮੀ ਸਰਦੀ ਮੀਹ ਬਾਰਿਸ਼ ਹਰ ਤਰ੍ਹਾਂ ਦੇ ਪ੍ਰਭਾਵ ਨੂੰ ਝੱਲ ਲੈਂਦੇ ਹਨ ਉੱਥੇ ਹੀ ਕੁਝ ਅਜਿਹੇ ਵੀ ਹਨ ਜਿਹਨਾਂ ਵਿੱਚ ਸਹਿਣਸ਼ੀਲਤਾ ਬਹੁਤ ਹੀ ਘੱਟ ਹੁੰਦੀ ਹੈ ਜਿਵੇਂ ਕਿ ਤੁਲਸੀ ਜੋ ਕਿ ਅੱਤ ਦੀ ਗਰਮੀ ਵਿੱਚ ਸੁੱਕ ਜਾਂਦੀ ਹੈ ਗਰਮੀ ਵਿੱਚ ਸਬਜ਼ੀ ਦੇ ਪੌਦੇ ਵੀ ਮੱਚਣ ਲੱਗਦੇ ਹਨ ਕਈ ਪੌਦਿਆਂ ਵਿੱਚ ਪਾਣੀ ਕਾਰਨ ਮਰ ਜਾਂਦੇ ਹਨ ਜਿਵੇਂ ਕਿ ਕੁਮਾਰ ਐਲੋਵੇਰਾ ਜਿਸ ਨੂੰ ਪਾਣੀ ਬਹੁਤ ਘੱਟ ਚਾਹੀਦਾ ਹੈ ਪਰ ਗਰਮੀਆਂ ਵਿੱਚ ਜਦੋਂ ਅਸੀਂ ਬਾਕੀ ਪੌਦਿਆਂ ਨੂੰ ਪਾਣੀ ਲਾਉਂਦੇ ਹਾਂ ਤਾਂ ਇਹਨਾਂ ਨੂੰ ਵੀ ਪਾ ਦਿੰਦੇ ਹਾਂ ਜਿਸ ਕਾਰਨ ਇਹ ਸੁੱਕ ਜਾਂਦੇ ਹਨ ਇਹਨਾਂ ਨੂੰ ਬਚਾਉਣ ਲਈ ਸਾਨੂੰ ਵੱਟਾਂ ਉੱਪਰ ਹੀ ਐਲੋਵੇਰਾ ਲਗਾਉਣਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਵੱਟਾਂ ਉੱਤੇ ਲਗਾਵਾਂਗੇ ਤਾਂ ਬਾਕੀ ਜਗ੍ਹਾ 'ਤੇ ਪੈਂਦਾ ਪਾਣੀ ਇਹਨਾਂ ਨੂੰ ਬਹੁਤ ਘੱਟ ਮਾਤਰਾ ਵਿੱਚ ਮਿਲੇਗਾ ਅਤੇ ਇਹ ਬਚ ਸਕਦੇ ਹਨ ਕੱਦੂ ਤੋਰੀ ਦੀਆਂ ਫ਼ਸਲਾਂ ਜਿੰਨਾ ਨੂੰ ਕਿ ਬਾਰਿਸ਼ ਵੀ ਮਾਰ ਦਿੰਦੀ ਹੈ ਅਤੇ ਜੇ ਜ਼ਿਆਦਾ ਗਰਮੀ ਹੋ ਜਾਵੇ ਤਾਂ ਵੀ ਇਹ ਮੱਚ ਜਾਂਦੇ ਹਨ ਤਾਂ ਸਾਨੂੰ ਅੱਜ ਕੱਲ੍ਹ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਇਸ ਨੂੰ ਇਹਨਾਂ ਚੀਜ਼ਾਂ ਤੋਂ ਬਚਾ ਸਕੀਏ ਜਿਵੇਂ ਕਿ ਗਰੀਨ ਹਾਊਸ ਘਰ ਬਣਾਉਣੇ ਚਾਹੀਦੇ ਹਨ ਜਿਨਾਂ ਵਿੱਚ ਇਹਨਾਂ ਨੂੰ ਲਗਾ ਕੇ ਇਹਨਾਂ ਨੂੰ ਇਹਨਾਂ ਦੇ ਲੋੜੀਂਦਾ ਤਾਪਮਾਨ ਦਿੱਤਾ ਜਾਵੇ ਤਾਂ ਕਿ ਇਹ ਬਚੇ ਰਹਿਣ ਪਿਛਲੇ ਸਾਲ ਨਿੰਮ ਵੀ ਸਰਦੀ ਦੀ ਮਾਰ ਹੇਠ ਆਏ ਸਨ ਜੋ ਕਿ ਹੁਣ ਤੱਕ ਹੀ ਫੁੱਟ ਰਹੇ ਹਨ ਅਤੇ ਬਚੇ ਨਹੀਂ ਇਸ ਤੋਂ ਤੁਲਸੀ ਸਰਦੀ ਨਹੀਂ ਝੱਲ ਸਕਦੀ ਇਸ ਨੂੰ ਸਰਦੀ ਤੋਂ ਬਚਾਉਣ ਲਈ ਕੁਝ ਅਜਿਹੇ ਮੈ ਪੈਮਾਨੇ ਸੈਟ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਕਿ ਅਸੀਂ ਇਸ ਨੂੰ ਬਚਾ ਸਕੀਏ ਕਮਰੇ ਵਿੱਚ ਇਸ ਨੂੰ ਰੱਖਣਾ ਚਾਹੀਦਾ ਹੈ ਤਾਂ ਜੋ ਕਿ ਇਹ ਸਰਦੀ ਤੋਂ ਬਚ ਸਕੇ ਗੁਲਾਬ ਗੁਲਾਬ ਜੋ ਹੈ ਇਹ ਵੀ ਗਰਮੀ ਨਹੀਂ ਝੱਲ ਸਕਦਾ ਗਰਮੀ ਦੇ ਮੌਸਮ ਵਿੱਚ ਗੁਲਾਬ ਦੀਆਂ ਪੱਤੀਆਂ ਝੜ੍ਹ ਜਾਂਦੀਆਂ ਹਨ ਪੱਤੇ ਮੁਰਝਾ ਜਾਂਦੇ ਹਨ ਅਤੇ ਗੁਲਾਬ ਮਰਨ ਦੇ ਕਿਨਾਰੇ ਹੋ ਜਾਂਦਾ ਹੈ ਪਰ ਇਸ ਨੂੰ ਬਚਾਉਣ ਲਈ ਵੀ ਸਾਨੂੰ ਇਸ ਨੂੰ ਲਗਾਤਾਰ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ ਪਾਣੀ ਪਾ ਕੇ ਗੁਲਾਬ ਨੂੰ ਨਮੀ ਦਿੱਤੀ ਜਾਂਦੀ ਰਹੇ ਰਹੇ ਅਤੇ ਇਸਦਾ ਤਾਪਮਾਨ ਵੀ ਬਰਾਬਰ ਰੱਖਿਆ ਜਾਵੇ ਗੁਲਦੌਤੀ ਗੁਲਦੌਤੀ ਇੱਕ ਫੁੱਲ ਦੀ ਕਿਸਮ ਹੈ ਜੋ ਕਿ ਰੰਗ ਬਿਰੰਗੇ ਫੁੱਲਾਂ ਕਰਕੇ ਮਸ਼ਹੂਰ ਹੈ ਇਹ ਵੀ ਜੁਲਾਈ ਤੋਂ ਸਤੰਬਰ ਵਿੱਚ ਹੀ ਖਿੜਦੇ ਹਨ ਜਦੋਂ ਕਿ ਸਾਡਾ ਬਾਰਿਸ਼ ਦਾ ਮੌਸਮ ਸ਼ੁਰੂ ਹੁੰਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਵੀ ਗਰਮੀ ਨਹੀਂ ਝੱਲਦੇ ਅਤੇ ਗਰਮੀ ਤੋਂ ਬਚਾਉਣ ਲਈ ਅਸੀਂ ਇਸ ਨੂੰ ਵੀ ਇਸ ਦਾ ਲੋੜੀਂਦਾ ਤਾਪਮਾਨ ਜਾਂ ਵਾਯੂਮੰਡਲ ਬਣਾ ਕੇ ਰੱਖ ਸਕਦੇ ਹਾਂ ਆਪਣੇ ਕਮਰਿਆਂ ਵਿੱਚ ਇਸ ਨੂੰ ਸਜਾ ਸਕਦੇ ਹਾਂ